ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਦਸ਼ਮੇਸ਼ ਟੂਰਿਸਟ ਤੋਂ ਬੋਲਦੇ ਹੋ ਜੀ ਹਾਂਜੀ ਅਸੀਂ ਨਾ ਜੀ ਇੱਥੇ ਹੋਲੇ ਮਹੱਲੇ 'ਤੇ ਜਾਣਾ ਆਨੰਦਪੁਰ ਸਾਹਿਬ ਜੀ ਹਾਂਜੀ ਸਾਨੂੰ ਇੱਕ ਕੈਬ ਦੀ ਜ਼ਰੂਰਤ ਹੈ ਜੀ ਅਸੀਂ ਪਹਿਲੀ ਵਾਰ ਅਸੀਂ ਸਾਡੀ ਫੈਮਿਲੀ ਹੈ ਜੀ ਪੰਜ ਜਣੇ ਹਾਂ ਅਸੀਂ ਫੈਮਲੀ ਦੇ ਹਾਂਜੀ ਹਾਂਜੀ ਗੱਡੀ ਵਧੀਆ ਸਾਫ਼ ਹੋਣੀ ਚਾਹੀਦੀ ਹੈ ਡਰਾਈਵਰ ਵਧੀਆ ਹੋਣਾ ਚਾਹੀਦਾ ਉਹਦੇ ਸਾਰੇ ਪਰੂਫ ਹੋਣੇ ਚਾਹੀਦੇ ਆ ਲਾਇਸੈਂਸ ਵਗੈਰਾ ਸਾਰਾ ਕੁਛ ਹੋਣਾ ਚਾਹੀਦਾ ਠੀਕ ਆ ਹਾਂਜੀ ਠੀਕ ਹੈ ਜੀ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਜੀ ਹੋਲੇ ਮਹੱਲੇ 'ਤੇ ਅਤੇ ਕਿਲੋਮੀਟਰ ਦੇ ਹਿਸਾਬ 'ਤੇ ਅਤੇ ਕਿੰਨਾ ਕਿਰਾਇਆ ਲਓਗੇ ਜੀ ਅਸੀਂ ਸਾਰਾ ਘੁੰਮਣਾ ਚਾਹੁੰਦੇ ਹਾਂ ਜੀ ਅਨੰਦਪੁਰ ਪਹਿਲੀ ਵਾਰੀ ਜਾ ਰਹੇ ਹਾਂ ਹਾਂਜੀ ਠੀਕ ਹੈ ਜੀ ਅਸੀਂ ਪਰਸੋਂ ਤੱਕ ਜਾਣਾ ਤੁਹਾਨੂੰ ਕਦੋਂ ਕਾਲ ਕਰੀਏ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਬਾਈ ਜੀ ਧੰਨਵਾਦ ਜੀ